ਮੈਂ ਰਾਮਦਾਸ ਪਿੰਡ ਨਵਾਂ ਗਰਾਮ ਤਹਿਸੀਲ ਡਾਕਖਾਨਾ ਸਿਆਲਪੁਰ ਤਹਿਸੀਲ ਅਤੇ ਜ਼ਿਲ੍ਹਾ ਪਠਾਨਕੋਟ ਦਾ ਰਹਿਣ ਵਾਲਾ ਮੈਨੂੰ ਬਾਗਬਾਨੀ ਦਾ ਸੌਂਕ ਹੈ ਅਤੇ ਮੈਂ ਬਾਗਬਾਨੀ ਕਰਨ ਵਿੱਚ ਰੁਚੀ ਰੱਖਦਾ ਮੈਂ ਬਾਗਬਾਨੀ ਵਾਸਤੇ ਗੈਂਤੀ ਕਹੀ ਖੁਰਪਾ ਅਤੇ ਦਾਤੀ ਆਦਿ ਦਾ ਇਸਤੇਮਾਲ ਕਰਦਾ ਅਤੇ ਗੈਂਤੀ ਦੇ ਨਾਲ ਜ਼ਮੀਨ ਨੂੰ ਮਤਲਬ ਕਿ ਸਖਤ ਜ਼ਮੀਨ ਹੋਏ ਤਾਂ ਉਹਨੂੰ ਖੋਦਿਆ ਜਾਂਦਾ ਕਹੀ ਨਾਲ ਵੀ ਖੁਦਾਈ ਕੀਤੀ ਜਾਂਦੀ ਕਹੀ ਜਿਹੜੀ ਆ ਉਹ ਗੈਂਤੀ ਨਾਲ ਪੁੱਟੀ ਹੋਈ ਮਿੱਟੀ ਨੂੰ ਭੁਰਭੂਰਾ ਬਣਾਉਂਦੀ ਹੈ ਅਤੇ ਖੁਰਪਾ ਜਿਹੜਾ ਉਹ ਉਹਦੇ ਨਾਲ ਪਹਿਲਾਂ ਘਾਹ ਜਿਹੜਾ ਹੈ ਉਹਨੂੰ ਕੱਢ ਲਿਆ ਜਾਂਦਾ ਫਿਰ ਦਾਤੀ ਵਗੈਰਾ ਜਿਹੜੀ ਆ ਉਹ ਘਾਏ ਘਾਹ ਨੂੰ ਉਹ ਵੀ ਇਸੇ ਕੰਮ ਵਿੱਚ ਵਰਤੀ ਜਾਂਦੀ ਵੀ ਘਾਹ ਨੂੰ ਕੱਢਿਆ ਜਾਂਦਾ ਉਹਦੇ ਨਾਲ ਫਿਰ ਇਹਦੇ ਵਾਸਤੇ ਬਾਲਟੀ ਦੀ ਵੀ ਵਰਤੋਂ ਕੀਤੀ ਜਾਂਦੀ ਜੇ ਕਿਤੇ ਨੇੜੇ ਕੋਈ ਮੋਟਰ ਵਗੈਰਾ ਨਹੀਂ ਹੋਏ ਅਤੇ ਪਾਣੀ ਜਿਹੜਾ ਬਾਲਟੀ ਨਾਲ ਵੀ ਦਿੱਤਾ ਜਾਂਦਾ ਬਾਲਟੀ ਫਿਰ ਮੱਗਾਂ ਦੇ ਨਾਲ ਮ ਜਿਹਦੇ ਨਾਲ ਬੂਟਿਆਂ ਨੂੰ ਪਾਣੀ ਦੇਣ ਵਾਸਤੇ ਉਹਦੀ ਵਰਤੋਂ ਕੀਤੀ ਜਾਂਦੀ ਹੈ ਫਿਰ ਹੋਰ ਵੀ ਇਸ ਤੋਂ ਇਲਾਵਾ ਕਈ ਸੰਦ ਨੇ ਅਤੇ ਜਿਸ ਤਰ੍ਹਾਂ ਆਪਣੀ ਲਾਂਟਾ ਵਗੈਰਾ ਜੇ ਕੋਈ ਪੱਥਰ ਹੈ ਵਿੱਚ ਜ਼ਮੀਨ ਦੇ ਵਿੱਚ ਉਹਨੂੰ ਚੁਣ ਚੁਣ ਕੇ ਉਹਦੇ 'ਚ ਪਾਇਆ ਜਾਂਦਾ ਘਾਹ ਨੂੰ ਚੁਣ ਚੁਣ ਕੇ ਅਤੇ ਇਹਨੂੰ ਮਤਲਬ ਕਿ ਵੱਟ 'ਤੇ ਰੱਖਿਆ ਜਾਂਦਾ ਹੈ ਫਿਰ ਜੇ ਉਹਨੂੰ ਧੁੱਪ ਦੇ ਵਿੱਚ ਸ਼ ਜੇ ਘਾਹ ਸੁੱਕ ਸੱਕ ਜਾਏ ਤਾਂ ਉਹਨੂੰ ਮਾਚਿਸ ਵਗੈਰਾ ਨਾਲ ਉਹਨੂੰ ਜਲਾ ਦਿੱਤਾ ਜਾਂਦਾ ਤਾਂ ਜੋ ਖਤਮ ਹੋ ਜੇ ਸੜ ਜਾਏ